ਸਤਿ ਸ਼੍ਰੀ ਅਕਾਲ ਭਾਅ ਜੀ ਕੌਣ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਭਾਅ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਮਤਲਬ ਢਾਬੇ ਤੁਸੀਂ ਪੁੱਛਣੇ ਐ ਨਾ ਕਿੱਥੇ ਕ ਰਹਿੰਦੇ ਤੁਸੀਂ ਅੱਛਾ ਮਾਨਵਤਾ ਨਗਰ ਉਹ ਜਿਹੜਾ ਸਟਾਈਲ ਹੋਟਲ ਦੇ ਨਾਲ ਆ ਮਤਲਵ ਅੱਛਾ ਜੀ ਤੁਹਾਡੇ ਕੋਲ ਤਾਂ ਕਈ ਢਾਬੇ ਤੁਹਾਨੂੰ ਮਿਲਜੂਗੇ ਆਸੇ ਪਾਸੇ ਮਤਲਬ ਕੀ ਖਾਣਾ ਕੀ ਆ ਮਤਲਵ ਅੱਛਾ ਬਰੇਕਫਾਸਟ ਕਰਨਾ ਬਰੇਕਫਾਸਟ ਲਈ ਤੁਸੀਂ ਜਨਤਾ ਦੇ ਪਰੌਂਠੇ ਖਾ ਲੋ ਸਵਾਦ ਹੁੰਦੇ ਆਲੂ ਵਾਲੇ ਲੱਸੀ ਦਾ ਤਾਂ ਨੀ ਪਤਾ ਪਰ ਪਰੌਂਠੇ ਜਰੂਰ ਮਿਲਜੂ ਹਾਂਜੀ ਹਾਂਜੀ ਚਾਹ ਤਾਂ ਮਿਲਜੂਗੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਆਪਣਾ ਨਾਨ ਵਗੈਰਾ ਜੀ ਕਿਹੜੇ ਨਾਨ ਮਤਲਵ ਆਲੂ ਨਾਨ ਜਾਂ ਬਟਰ ਨਾਨ ਵਗੈਰਾ ਜਿਹੜੇ ਹੁੰਦੇ ਮਤਲਵ ਆਲੂ ਨਾਨ ਆਨੰਦ ਢਾਬੇ ਤੋਂ ਪਤਾ ਕਰ ਲਿਓ ਉਹਦੇ ਮਿਲ ਜਾਣੇ ਚਾਹੀਦੇ ਪਰ ਉੱਦਾਂ ਹਾਂਜੀ ਹਾਂਜੀ ਹੋਰ ਇੱਕ ਤਾ ਜੀ ਗੋਗੀ ਦਾ ਢਾਬਾ ਵਾ ਉਥੇ ਮਤਲਬ ਪਰੌਂਠੇ ਵਗੈਰਾ ਵਧੀਆ ਮਿਲ ਜਾਂਦੇ ਮਾਲਪੁਰ ਦੇ ਅੱਡੇ ਮਿਲ ਜਾਊਗਾ ਵੀ ਤੁਹਾਨੂੰ ਜਨਤਾ ਢਾਬੇ ਦੇ ਕੋਲ ਈ ਹਾਂਜੀ ਲੰਚ ਵਗੈਰਾ ਦੇਖੋ ਜੀ ਲੰਚ ਵਗੈਰਾ ਤੁਸੀਂ ਕਰਨਾ ਤਾਂ ਉਹ ਆਪਣਾ ਅਨਪੂਲਨ ਢਾਬਾ ਵਧੀਆ ਉਹਦਾ ਚੀਜ਼ ਚਿਲੀ ਬਹੁਤ ਫੇਮਸ ਆ ਔਰ ਦਾਲ ਬਹੁਤ ਫੇਮਸ ਆ ਪਨੀਰ ਲਗਾ ਲੋ ਬਹੁਤ ਫੇਮਸ ਆ ਔਰ ਚੀਜ਼ ਟਮਾਟੋ ਬਹੁਤ ਫੇਮਸ ਆ ਮੈਂ ਜੋ ਜੋ ਤੁਹਾਨੂੰ ਆਈਟਮਾਂ ਦੱਸੀਆਂ ਸਾਰੀਆਂ ਖਾਦੀਆਂ ਵੀ ਬਹੁਤ ਸਵਾਦ ਆ ਜੀ ਕੜਾਈ ਪਨੀਰ ਵੀ ਖਾਦਾ ਬਹੁਤ ਸਵਾਦ ਆ ਹੋਰ ਪ੍ਰਕਾਸ਼ ਦਾ ਢਾਬਾ ਇੱਕ ਉੱਥੇ ਪਤਾ ਨਹੀਂ ਭਾਅ ਜੀ ਮੈਂ ਨਾਮ ਈ ਸੁਣਿਆ ਉਹਦਾ

ਇਹ ਭਾਅ ਜੀ ਤੁਹਾਨੂੰ ਮੈਨੂੰ ਐਗਜੈਟਲੀ ਨੀ ਪਤਾ ਪਰ ਰੇਲਵੇ ਰੋਡ ਦੇ ਲਾਗੇ ਪੈ ਜੁਗਾ

ਪਨੀਰ ਦੀ ਭੁਰਜੀ ਕਹਿੰਦੇ ਉਦਾਂ ਸੁਣਿਆ ਮਤਲਵ ਕੀ ਉਹਦਾ ਇੰਸਟਾਗ੍ਰਾਮ ਤੇ ਯੂਟਿਊਬ ਵਗੈਰਾ ਤੇ ਪਰ ਹਾਂਜੀ ਜੋ ਮਰਜੀ ਦੇਖ ਲਿਓ ਨਹੀਂ ਰੋਟੀ ਦੇ ਦਿੰਦੇ ਹਾਂਜੀ ਹਾਂਜੀ ਹੋਰ ਦੇਖੋ ਜੀ ਤੁਸੀਂ ਜੇ ਕੜੀ ਖਾਣਾ ਚਾਹੁੰਦੇ ਹੋ ਜਨਤਾ ਦੇ ਢਾਬੇ ਜਾ ਸਕਦੇ ਓ ਬਹੁਤ ਸੁਆਦ ਬ੍ਰੇਕਫਾਸਟ ਤੁਸੀਂ ਦੇਖੋ ਮੈਂ ਪੂਰੀਆਂ ਹੀ ਕਰਨਾ ਜਿਆਦਾ ਜਾ ਕਚੋਰੀਆਂ ਹਾਂਜੀ ਹਾਂਜੀ ਫੇਵਰੇਟ ਅਨਪੂਰਨਾ ਦਾ ਢਾਬਾ ਓਕੇ ਓਕੇ